ਹੈਲੋ ਹਾਂਜੀ ਆਪਣਾ ਬੁੱਕਸ ਸੇਲਰ ਆਪਣੀ ਤੇ ਸ਼ੋਪ ਤੋਂ ਬੋਲ ਰਹੇ ਹੋ ਤੁਸੀਂ ਸ਼ੂਜ ਵਗੈਰਾ ਦੇ ਸ਼ੂਜ ਮੇਕਰ ਬੋਲ ਰਹੇ ਹੋ ਅੱਛਾ ਬ੍ਰਦਰ ਮੈਂ ਨਾ ਇੰਟਰਨੈਟ 'ਤੇ ਤੁਹਾਡਾ ਅ ਸ਼ੂਜ ਵਗੈਰਾ ਦੇਖੇ ਸੀਗੇ ਮੈਂ ਅਤੇ ਥੋੜ੍ਹੇ ਜਿਹੇ ਰੇਟ ਤੁਹਾਡੇ ਕੁਛ ਜ਼ਿਆਦਾ ਹਾਈ ਨੇ ਦੱਸ ਰੇਟ ਬਹੁਤ ਜ਼ਿਆਦਾ ਤੁਹਾਡੇ ਉਹ ਨੇ ਅਤੇ ਕੌਂਪਨੀ ਦੇ ਨੇ ਇਹ ਬ੍ਰਦਰ ਬਿਲਕੁਲ ਮਾਰਕਾ ਹੈ ਕਿ ਓਰੀਜਨਲ ਨੇ ਬਿਲਕੁਲ ਅੱਛਾ ਇਹਨਾਂ ਦੇ ਦਸ ਪਰਸੈਂਟ ਹੀ ਹੁੰਦਾ ਹਾਂ ਮੈਂ ਤਾਂ ਉਹ ਨੈੱਟ 'ਤੇ ਦੇਖਿਆ ਸੀ ਤੁਹਾਡਾ ਫਿਰ ਮਤਲਬ ਦੇਖਿਆ ਮੈਂ ਕਿਹਾ ਚਲੋ ਮੈਂ ਕਾਲ ਹੀ ਕਰ ਲੈਂਦਾ ਵੈਸੇ ਤੁਹਾਡੀ ਕੁਆਲਿਟੀ ਤਾਂ ਚਲੋ ਅੱਛਾ ਮਤਲਬ ਵੀ ਓਕੇ ਓਕੇ ਓਕੇ ਓਕੇ ਜੀ ਓਕੇ ਓਕੇ ਮੈਂ ਨੈਟ 'ਤੇ ਇਸੇ ਕਰਕੇ ਪਤਾ ਕੀ ਗੱਲ ਹੈ ਮੈਂ ਦੇਖਿਆ ਸੀ ਤੁਹਾਡਾ ਤੇ ਥੋੜ੍ਹੀ ਜਿਹੀ ਰੇਟ ਦਾ ਹੀ ਮੈਨੂੰ ਥੋੜ੍ਹੀ ਕਨਫਰਮ ਮੈਂ ਕਰਨਾ ਸੀਗਾ ਅਤੇ ਕੁਆਲਿਟੀ ਕੁਆਲਿਟੀ ਪੱਖੋਂ ਚਲੋ ਮਤਲਬ ਵੀ ਮੈਂ ਵਿਜਿਟ ਕਰੂੰਗਾ ਵਿਜਿਟ ਕਰ ਕੇ ਫਿਰ ਉਸ ਤੋਂ ਬਾਅਦ ਬਸ ਮਤਲਬ ਲੇਡੀਜ ਵੀ ਲੈਣੇ ਆ ਜੈਂਟਸ ਵੀ ਲੈਣੇ ਆ ਅਤੇ ਬੱਚਿਆਂ ਦੇ ਵੀ ਮਤਲਬ ਲੈਣੇ ਨੇ ਬਸ ਜੀ ਜੈਕਚਲ ਪਤਾ ਕੀ ਗੱਲ ਹੈ ਅੱਜ ਕੱਲ੍ਹ 'ਚ ਥੋੜ੍ਹੇ ਜਿਹਾ ਇਹ ਲੱਗਦਾ ਵੀ ਉਹਦਾ ਸਭ ਕੁਝ ਕਹਿ ਲਓ ਉਹ ਹੁੰਦਾ ਕੁਆਲਟੀ ਦਾ ਫਿਰ ਕੁਆਲਿਟੀ ਹੁੰਦੀ ਹੈ ਥੋੜ੍ਹਾ ਜਿਹਾ ਉਹ ਹੋ ਜਾਂਦਾ ਵੀ ਮਤਲਬ ਕਿਤੇ ਕੋਈ ਇਹਨਾਂ ਦੀ ਕੋਈ ਫ ਫਰੋਡ ਟਾਈਪ ਨਾ ਹੋਵੇ ਨਾ ਨਹੀਂ ਚਲੋ ਉਹ ਤਾਂ ਮੈ ਮੈਂ ਤਾਂ ਉਹ ਨੈੱਟ 'ਤੇ ਫਿਰ ਤੁਹਾਡਾ ਮੈਂ ਦੇਖਿਆ ਵਧੀਆ ਲੱਗਿਆ ਖੈਰ ਮੈਨੂੰ ਓਹੀ ਜਿਹੀ ਗੱਲ ਨਹੀਂ ਰੇਟ ਹੀ ਥੋੜ੍ਹੇ ਜਿਹੇ ਕੰਫਰਮ ਕਰਨੇ ਸੀਗੇ ਬਸ ਫਿਰ ਕੋਈ ਗੱਲ ਨਹੀਂ ਤੁਹਾਡੀ ਵਿਜਿਟ ਕਰਦੇ ਹਾਂ ਅੱਛਾ ਦਸ ਪਰਸੈਂਟ ਮਾਰਜਨ 'ਤੇ ਦੇ ਰਹੇ ਹੋ ਕੁਛ ਹੋਰ ਨਹੀਂ ਥੋੜ੍ਹਾ ਮੋਟਾ ਕੋਈ ਮਤਲਬ ਵੀ ਜਿਵੇਂ ਹੁਣ ਸਾਰੀ ਫੈਮਲੀ ਦੇ ਅਸੀਂ ਉਹ ਕਰਨੇ ਆ ਬਾਕੀ ਮੇਰੇ ਜਿਹੜੇ ਹੋਰ ਵੀ ਕੋਈ ਕਲੋਜ ਜਿਹੜੇ ਹੈਗੇ ਨੇ ਜਿਵੇਂ ਰੈਲੇਟਿਵ ਹੋ ਗਏ ਜਾਂ ਮੇਰੇ ਕੋਈ ਵੀ ਚਲੋ ਆਪਾਂ ਹੋਰ ਵੀ ਮਤਲਬ ਵ ਵੱਧ ਤੋਂ ਵੱਧ ਤੁਹਾਡੇ ਸੇਲ ਕਰਾਵਾਂਗੇ ਓਕੇ ਜੀ ਜੀ ਜੀ ਚਲੋ ਠੀਕ ਹੈ ਫਿਰ ਵਿਜਿਟ ਬ੍ਰਦਰ ਤੁਹਾਡੇ ਕੋਲ ਮਤਲਬ ਵੀ ਇਕ ਅੱਧੇ ਦਿਨ ਤੱਕ ਅਸੀਂ ਤੁਹਾਡੇ ਕੋਲ ਵਿਜਿਟ ਕਰਦੇ ਹਾਂ ਅਤੇ ਫਿਰ ਆਪਾਂ ਦੇਖਦੇ ਹਾਂ ਅਤੇ ਲੈਂਦੇ ਹਾਂ ਫਿਰ ਹੈ ਨਾ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਠੀਕ ਹੈ ਥੈਂਕ ਯੂ ਵੀਰ ਜੀ ਥੈਂਕ ਯੂ ਸਰ ਓਕੇ ਓਕੇ ਮਿਲਦੇ ਹਾਂ ਸਰ ਜਲਦੀ